ਭੰਗੜਾ ਐਰੋਬਿਕਸ ਇੱਕ ਐਕਸਰਸਾਈਜ਼ ਦਾ ਫੋਰਮ ਹੈ ਜਿਹੜਾ ਕਿ ਕੰਬਾਈਨ ਕਰਦਾ ਇੱਕ ਟਰਡੀਸ਼ਨਲ ਭੰਗੜਾ ਡਾਂਸ ਜਿਹੜਾ ਕਿ ਪੰਜਾਬ ਰੀਜ਼ਨ ਤੋਂ ਆਇਆ ਹੈ ਅਤੇ ਉਹਦੇ ਨਾਲ ਹੀ ਐਰੋਬਿਕਸ ਫਿੱਟਨੈਸ ਇੱਕ ਟਾਈਪ ਓਫ ਐਕਸਰਸਾਈਜ਼ ਆ ਫੋਰ ਡੇਲੀ ਰੂਟੀਨ ਲਈ ਇਹਨਾਂ ਦੋਨਾਂ ਨੂੰ ਮਿਲਾ ਕੇ ਭੰਗੜਾ ਐਰੋਬਿਕਸ ਬਣਾਇਆ ਗਿਆ ਹੈ ਇਹ ਜਿਹੜਾ ਫਿਊਜ਼ਨ ਕ੍ਰੀਏਟ ਕੀਤਾ ਹੈ ਇਹ ਹਾਏ ਐਨਰਜੀ ਵਰਕਆਊਟ ਲਈ ਹੁੰਦਾ ਹੈ ਇਹਨੂੰ ਹਾਏ ਐਨਰਜੀ ਵਰਕਆਊਟ ਲਈ ਕਾਫੀ ਪਾਰਟੀਸਪੈਂਟਸ ਕਾਫੀ ਯੂਮਿਨਸ ਕਰਦੇ ਹਨ ਜਿਹਦੇ ਵਿੱਚ ਫਨ ਵੀ ਹੁੰਦਾ ਅਤੇ ਇਫੈਕਟਿਵ ਵੀ ਹੁੰਦਾ ਬੋਡੀ ਲਈ ਹੈੱਲਥ ਲਈ ਜਿਹਦੇ ਵਿੱਚ ਕਿ ਬਹੁ ਲਾਈਵ ਮਿਊਜ਼ਿਕ ਚੱਲਦਾ ਅੱਡ ਅੱਡ ਐਲੀਮੈਂਟਸ ਹੁੰਦੇ ਹੈ ਭੰਗੜਾ ਦੇ ਅੱਡ ਅੱਡ ਮੂਵਮੈਂਟਸ ਹੁੰਦੇ ਆ ਜਿਹਦੇ ਬਹੁਤ ਬੈਨੀਫਿਟ ਹੁੰਦੇ ਆ ਪਾਰਟੀਸਪੈਂਟਸ ਨੂੰ ਹਿਊਮਨਸ ਨੂੰ ਜਿਹੜੇ ਕਿ ਭੰਗੜਾ ਐਰੋਬਿਕ ਪਰਫੋਰਮ ਕਰਦੇ ਆ ਜਿਵੇਂ ਕਿ ਭੰਗੜਾ ਐਰੋਬਿਕ ਪਰਫੋਰਮ ਕਰਨ ਨਾਲ ਇਹਦਾ ਹਾਰਟ ਰੇਟ ਪਰਸਨ ਦਾ ਹਾਏ ਰਹਿੰਦਾ ਵਧੀਆ ਰਹਿੰਦਾ ਉਹਨਾਂ ਦੀ ਮਾਇੰਡ ਅਤੇ ਬੋਡੀ ਕੋਰਡੀਨੇਸ਼ਨ ਵਧੀਆ ਹੁੰਦੀ ਹੈ ਇਮਪਰੂਵ ਹੁੰਦੀ ਹੈ ਜਿਹਨਾਂ ਕਰਕੇ ਉਹਨਾਂ ਦਾ ਮਨ ਲੱਗਿਆ ਰਹਿੰਦਾ ਹਰ ਇੱਕ ਕੰਮ ਵਿੱਚ ਅਤੇ ਉਹਨਾਂ ਦੇ ਵਿੱਚ ਇਨਬਿਲਟ ਐਨਰਜੀ ਹੋਰ ਜ਼ਿਆਦਾ ਫੋਰਮ ਹੁੰਦੀ ਆ ਜਿਹਨਾਂ ਕਰਕੇ ਉਹ ਚੌਵੀ ਘੰਟੇ ਵਧੀਆ ਹੱਸਦੇ ਖੇਡਦੇ ਰਹਿੰਦੇ ਹਨ ਜੇ ਆਪਾਂ ਕਹਿ ਲਈਏ ਨੋਰਮਲੀ ਭੰਗੜਾ ਐਰੋਬਿਕਸ ਸੈਸ਼ਨ ਜਿਹੜੇ ਹੁੰਦੇ ਆ ਉਹਦੇ ਵਿੱਚ ਪਾਰਟੀਸਪੈਂਟ ਕਾਫੀ ਤਰ੍ਹਾਂ ਦੀਆਂ ਐਲੀਮੈਂਟਸ ਮੂਵਮੈਂਟਸ ਡਾਇਨਾਮਿਕ ਮੂਵਮੈਂਟਸ ਪਰਫੋਰਮ ਕਰਦੇ ਆ ਜਿਵੇਂ ਕਿ ਭੰਗੜਾ ਮੂਵਸ ਲਾਈਕ ਝੂਮਰ ਹੁੰਦਾ ਧਮਾਲ ਹੁੰਦਾ ਬੱਲੇ ਬੱਲੇ ਜਿਹਦੇ ਵਿੱਚ ਕੀ ਹੁੰਦਾ ਵੀ ਉਹ ਜੰਪ ਕਰਦੇ ਆ ਉਹਨਾਂ ਦੀ ਆਰਮ ਮੂਵਮੈਂਟਸ ਹੁੰਦੀਆਂ ਉਹਨਾਂ ਦੀ ਲੈਗ ਮੂਵਮੈਂਟਸ ਹੁੰਦੀਆਂ ਫੁੱਟਵਰਕ ਕਾਫੀ ਜ਼ਿਆਦਾ ਹੁੰਦਾ ਫੁੱਟਵਰਕ ਨੋਰਮਲੀ ਹੁੰਦਾ ਹੀ ਹੁੰਦਾ ਇਹ ਸਟੈਪਸ ਜਿਹੜੀਆਂ ਉਹ ਸਾਰੀਆਂ ਮਿਕਸ ਕਰਦੇ ਆ ਮੋਰਡਨ ਐਕਸਰਸਾਈਜ਼ ਦੇ ਨਾਲ ਜਿਹੜਾ ਕਿ ਇੰਗੇਜ ਕਰਦਾ ਫੁੱਲ ਬੋਡੀ ਵਰਕਆਊਟ ਤਾਂ ਕਰਕੇ ਕਾਫੀ ਪਾਰਟੀਸਪੈਂਟ ਭੰਗੜਾ ਐਰੋਬਿਕਸ ਦੀ ਕਲਾਸਿਸ ਐਕਸਰਸਾਈਜ਼ ਕਰਦੇ ਹਨ ਜੇ ਇਹ ਮੈਂ ਪਹਿਲੀ ਵਾਰ ਮੈਂ ਆਪਦੇ ਫਰੈਂਡਸ ਤੋਂ ਸੁਣਿਆ ਸੀ ਜਦੋਂ ਮੈਂ ਗ੍ਰੈਜੂਏਸ਼ਨ ਕਰ ਰਹੀ ਸੀ ਮੇਰੀ ਇੱਕ ਫਰੈਂਡ ਹੈ ਜੋ ਪੰਜਾਬ ਵਿੱਚ ਰਹਿੰਦੀ ਹਨ ਚੰਡੀਗੜ੍ਹ ਵਿੱਚ ਉਹਨੇ ਭੰਗੜਾ ਐਰੋਬਿਕਸ ਪਹਿਲੀ ਵਾਰ ਜੁਆਇਨ ਕੀਤਾ ਸੀ ਉਹਨੇ ਮੈਨੂੰ ਦੱਸਿਆ ਕਿ ਇਹਦੇ ਕਿੰਨੇ ਫਾਇਦੇ ਹੁੰਦੇ ਹਨ ਇਹਦੇ ਵਿੱਚ ਆਪਾਂ ਟ੍ਰਡੀਸ਼ਨਲ ਆਰਟ ਫੋਰਮ ਕਰ ਸਕਦੇ ਹਾਂ ਨਾਲ ਹੀ ਉਹਦੇ ਮੋਰਡਨ ਵਰਕਆਊਟ ਮ ਮੋਰਡਨ ਟਰੈਂਡ ਵਿੱਚ ਕਰ ਸਕਦੇ ਹਨ ਜਿਹਦੀ ਕਿ ਬਹੁਤ ਜ਼ਿਆਦਾ ਪੋਪੂਲੈਰਿਟੀ ਹੋ ਗਈ ਸੀਗੀ ਇੰਡੀਆ ਦੇ ਵਿੱਚ ਤਾਂ ਕਰਕੇ ਮੈਂ ਇਹ ਪਹਿਲੀ ਵਾਰ ਉੱਥੇ ਸੁਣਿਆ ਸੀ ਨਾਲ ਗਰੁੱਪ ਕਲਾਸਿਸ ਦੇ ਵਿੱਚ ਵੀ ਕਾਫੀ ਮੈਂ ਸੁਣਿਆ ਹਨ ਤਾਂ ਪਹਿਲੀ ਵਾਰ ਮੈਂ ਉੱਥੇ ਸੁਣਿਆ